ਪਰਸੋਂ ਮੇਰੇ ਫੋਨ ਵਿੱਚ ਜੀਓ ਦਾ ਰੀਚਾਰਜ ਮੁੱਕ ਗਿਆ ਸੀ ਅਤੇ ਮੈਂ ਸੱਤ ਸੌ ਉੱਨੀ ਵਾਲਾ ਰਿਚਾਰਜ ਆਪਣੇ ਫੋਨ ਦੇ ਉੱਤੇ ਕਰਵਾਇਆ ਸੀ ਪ੍ਰੰਤੂ ਸੱਤ ਸੌ ਉੱਨੀ ਦਾ ਰੀਚਾਰਜ ਕਰਵਾਉਣ ਦੇ ਬਾਵਜੂਦ ਵੀ ਮੇਰੇ ਫੋਨ ਵਿੱਚ ਰੀਚਾਰਜ ਹੋਇਆ ਨਹੀਂ ਹੈ ਰੀਚਾਰਜ ਕਰਵਾਉਣ ਤੋਂ ਬਾਵਜੂਦ ਮੈਨੂੰ ਰੀਚਾਰਜ ਸਕਸੈੱਸਫੁੱਲ ਹੋਣ ਦਾ ਮੈਸੇਜ ਆ ਗਿਆ ਸੀ ਪਰੰਤੂ ਹੁਣ ਨਾ ਤਾਂ ਮੈਂ ਕਿਸੇ ਨੂੰ ਫੋਨ ਕਰ ਪਾ ਰਹੀ ਹਾਂ ਨਾ ਮੈਨੂੰ ਕਿਸੇ ਦਾ ਮੈਸੇਜ ਆ ਰਿਹਾ ਵਾ ਨਾ ਤਾਂ ਮੈਂ ਕੋਈ ਵਟਸਐਪ ਯੂਜ ਕਰ ਪਾ ਰਹੀ ਹਾਂ ਜੋ ਕਿ ਮੇਰੇ ਵਾਸਤੇ ਬਹੁਤ ਜ਼ਰੂਰੀ ਹੈ ਮੈਂ ਆਪਣਾ ਕਾਰੋਬਾਰ ਉੱਥੋਂ ਹੀ ਕਰਨਾ ਹੁੰਦਾ ਹੈ ਹੁਣ ਮੈਂ ਉਸ ਕੰਮ ਨੂੰ ਆਪਣਾ ਪੂਰਾ ਕਿਵੇਂ ਕਰੂੰਗੀ ਜੇ ਮੈਂ ਸੱਤ ਸੌ ਉੱਨੀ ਵਾਲਾ ਰੀਚਾਰਜ ਕਰਵਾਇਆ ਸੀਗਾ ਅਤੇ ਉਹ ਮੈਸੇਜ ਹੋਣ ਦੇ ਬਾਵਜੂਦ ਵੀ ਮੇਰਾ ਰੀਜਾਰਚ ਪਿਆ ਕਿਉਂ ਨਹੀਂ ਮੈਨੂੰ ਇਸ ਚੀਜ਼ ਦਾ ਜਵਾਬ ਚਾਹੀਦਾ ਹੈ ਮੇਰੇ ਸੱਤ ਸੌ ਉੱਨੀ ਰੁਪਏ ਵੇਸਟ ਤਾਂ ਨਹੀਂ ਜਾਣਗੇ ਅਗਰ ਉਹ ਕਿਸੀ ਵੀ ਪ੍ਰਕਾਰ ਵੇਸਟ ਹੋ ਜਾਂਦੇ ਹਨ ਤਾਂ ਮੈਨੂੰ ਉਹਨਾਂ ਨੂੰ ਸੱਤ ਸੌ ਉੱਨੀ ਵਾਪਿਸ ਚਾਹੀਦੇ ਹਨ ਕਿਸੇ ਵੀ ਤਰ੍ਹਾਂ ਮੈਨੂੰ ਮੇਰੇ ਜੀਓ ਦਾ ਰੀਚਾਰਜ ਹੁਣੇ ਕਰ ਕਰਵਾ ਕੇ ਦਿਓ ਕਿਉਂਕਿ ਮੈਂ ਕੱਲ੍ਹ ਦੀ ਉਡੀਕ ਕਰ ਰਹੀ ਹਾਂ ਕਿ ਮੇਰਾ ਰੀਚਾਰਜ ਮੈਂ ਕਰਵਾਇਆ ਹੈ ਪਰ ਮੇਰਾ ਨੈਟ ਨਹੀਂ ਚੱਲ ਰਿਹਾ ਹੈ ਮੈਨੂੰ ਬਹੁਤ ਸਾਰੇ ਜ਼ਰੂਰੀ ਜ਼ਰੂਰੀ ਕੰਮ ਕਰਨੇ ਹੁੰਦੇ ਹਨ ਜੋ ਕਿ ਮੇਰੇ ਇਸ ਕਾਰਨ ਰੁੱਕ ਗਏ ਹਨ ਅਤੇ ਹੁਣ ਇਸ ਦਾ ਜ਼ਿੰਮੇਵਾਰ ਕੌਣ ਹੋਵੇਗਾ ਅਤੇ ਤੁਸੀਂ ਪਲੀਜ਼ ਜੋ ਮਰਜ਼ੀ ਕਰਕੇ ਮੇਰਾ ਇਹ ਕੰਮ ਸਭ ਤੋਂ ਪਹਿਲਾਂ ਪੂਰਾ ਕਰੋ ਨਹੀਂ ਤਾਂ ਮੈਂ ਕੋਈ ਵੀ ਤੁਹਾਡੇ ਵੱਲੋਂ ਐਕਸ਼ਨ ਕਰ ਸਕਦੀ ਹਾਂ